ਜਿਹੜੇ ਜਿਹੜੇ ਵੀ ਮਕੈਨੀਕਲ ਕੰਮ ਮੈਂ ਜਦੋਂ ਬਾਈਕ 'ਤੇ ਜ਼ਰੂਰ ਜਾਂਦਾ ਉਹ ਮੈਂ ਸਾਰੇ ਚੈੱਕ ਕਰਦਾ ਹਾਂ ਅਤੇ ਇੱਕ ਮੇਰੇ ਮਨ ਵਿੱਚ ਸਭ ਤੋਂ ਵੱਡਾ ਹੈ ਖਿਆਲ ਇਹ ਆਉਂਦਾ ਹੈ ਕਿ ਉਹਦਾ ਸਾਰਾ ਜਿੰਨੀ ਵੀ ਉਹਦੇ ਬਾਈਕ ਨਾਲ ਸੰਬੰਧਿਤ ਇੱਕ ਇੱਕ ਚੀਜ਼ ਨੂੰ ਮੈਂ ਮੱਦੇਨਜ਼ਰ ਰੱਖ ਕੇ ਚੈੱਕ ਕਰਵਾਉਂਦਾ ਸਭ ਤੋਂ ਪਹਿਲਾਂ ਮੈਂ ਉਸਦੀ ਹਵਾ ਜਾਂ ਪ੍ਰੈਸ਼ਰ ਚੈੱਕ ਕਰਵਾਉਂਦਾ ਫਿਰ ਉਸਦੇ ਜਿੰਨੇ ਵੀ ਮਕੈਨੀਕਲ ਕੰਮ ਹੁੰਦੇ ਹਨ ਜਿਵੇਂ ਤੇਲ ਚੈੱਕ ਕਰਨਾ ਉਸ 'ਤੇ ਹ ਜਿੰਨੇ ਵੀ ਗੈਸ ਘੱਟ ਹੈ ਉਹ ਸਭ ਚੈੱਕ ਕਰਵਾਉਂਦਾ ਹਾਂ ਔਰ ਉਸਦੇ ਨਾਲ ਨਾਲ ਉਸ ਨਾਲ ਸੰਬੰਧਿਤ ਜਿੰਨੀਆਂ ਵੀ ਮਕੈਨੀਕਲ ਚੀਜ਼ਾਂ ਮੈਂ ਚੈੱਕ ਕਰਦਾ ਹਾਂ ਕਿ ਕੱਲ੍ਹ ਨੂੰ ਜਿਸ ਤਰ੍ਹਾਂ ਅਸੀਂ ਲੋਂਗ ਰੂਟ 'ਤੇ ਜਾ ਰਹੇ ਹਾਂ ਅਤੇ ਰਸਤੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਖ਼ਰਾਬੀ ਨਾ ਆਏ ਜਦੋਂ ਮੈਂ ਆਫਰੋਡਿੰਗ 'ਤੇ ਜਾਂਦਾ ਹਾਂ ਰਸਤੇ ਦੇ ਵਿੱਚ ਜਿਸ ਤਰ੍ਹਾਂ ਬਾਈਕ ਦਾ ਕੁਛ ਖ਼ਰਾਬੀ ਨਾ ਆ ਜਾਵੇ ਇਸ ਕਰਕੇ ਮੈਂ ਪਹਿਲਾਂ ਹੀ ਉਸਨੂੰ ਚੈੱਕ ਕਰਵਾ ਲੈਂਦਾ ਹਾਂ ਅਤੇ ਉਸਦੇ ਨਾਲ ਨਾਲ ਮੈਂ ਇੱਕ ਚੀਜ਼ ਆਪਣੇ ਧਿਆਨ 'ਚ ਰੱਖਦਾ ਹਾਂ ਕਿ ਪੈਟਰੋਲ ਆਪਣੇ ਨਾਲ ਵੀ ਲੈ ਕੇ ਜਾਂਦਾ ਹਾਂ ਕਿ ਰਸਤੇ ਦੇ ਵਿੱਚ ਜਾਵੇ ਮੈਨੂੰ ਕੁਛ ਪੈਟਰੋਲ ਪੰਪ ਨਾ ਮਿਲੇ ਤਾਂ ਮੈਂ ਆ ਖੁਦ ਥੋੜ੍ਹੇ ਥੋੜ੍ਹੇ ਸਮੇਂ ਦੇ ਵਾਸਤੇ ਪੈਟਰੋਲ ਬੋਤਲ ਦੇ ਵਿੱਚ ਭਰ ਕੇ ਲੈ ਕੇ ਜਾਵਾਂ ਅਤੇ ਰਸਤੇ ਵਿੱਚ ਮੈਨੂੰ ਕੋਈ ਤੰਗੀ ਨਾ ਆ ਸਕੇ ਅਤੇ ਇਸ ਕਰਕੇ ਇੱਕ ਅੱਛੇ ਬਾਈਕਰ ਦੇ ਹੋਣ ਦੇ ਨਾਤੇ ਇਹ ਸਾਰੀਆਂ ਚੀਜ਼ਾਂ ਮੈਂ ਮੱਦੇਨਜ਼ਰ ਰੱਖਦਾ ਹਾਂ ਅਤੇ ਮੈਂ ਇੱਕ ਆਪਣੇ ਨਾਲ ਸਾਰੇ ਦਾ ਸਾਰੇ ਟੂਲ ਕਿਟ ਵੀ ਨਾਲ ਲੈ ਕੇ ਜਾਂਦਾ ਹਾਂ ਕਿ ਰਸਤੇ ਦੇ ਵਿੱਚ ਅਗਰ ਕੋਈ ਖ਼ਰਾਬੀ ਆਵੇ ਤਾਂ ਮੈਂ ਉਸਨੂੰ ਸਾਰਾ ਕੁਛ ਚੈੱਕ ਕਰਕੇ ਉਸ ਨੂੰ ਅੱਛੀ ਤਰ੍ਹਾਂ ਨਾਲ ਆਪਣੇ ਡਰਾਈਵ ਕਰ ਸਕਾਂ